ਜਦੋਂ ਵੀ ਮੇਰੇ ਕੋਲ ਵਿਹਲਾ ਟਾਈਮ ਹੁੰਦਾ ਹੈ ਮੇਰੇ ਕੋਲ ਕੁਛ ਕਰਨ ਨੂੰ ਨਹੀਂ ਹੁੰਦਾ ਹੈ ਮੇਰਾ ਇਹ ਬਹੁਤ ਹੀ ਅਜ਼ੀਜ਼ ਦੋਸਤ ਹਨ ਪਿੰਡ ਵਿੱਚ ਅਤੇ ਮੈਂ ਉਹਨਾਂ ਨੂੰ ਫੋਨ ਕਰਦਾ ਹਾਂ ਅਤੇ ਅਸੀਂ ਸਾਰੇ ਜਣੇ ਇਕੱਠੇ ਹੋ ਜਾਂਦੇ ਹਨ ਗੁਰਦੁਆਰੇ ਦੇ ਲੰਗਰ ਹਾਲ 'ਚ ਅਤੇ ਉੱਥੇ ਬੈਠ ਕੇ ਅਸੀਂ ਗੱਲਾਂ ਕਰਦੇ ਹਨ ਪਿੰਡ ਬਾਰੇ ਰਾਜਨੀਤਿਕ ਗੱਲਾਂ ਹੋ ਜਾਂਦੀਆਂ ਹਨ ਹੋਰ ਸਹੂਲਤਾਂ ਨੌਕਰੀਆਂ ਬਾਰੇ ਵਿਦੇਸ਼ਾਂ ਬਾਰੇ ਅਸੀਂ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਹਨ ਅਤੇ ਅਸੀਂ ਫਿਰ ਲੂਡੋ ਦਾ ਮੈਚ ਵੀ ਖੇਲਦੇ ਹਨ ਇੱਥੇ ਫਿਰ ਦੁਪਹਿਰੇ ਦੁਪਹਿਰੇ ਤਾਂ ਸਾਡੇ ਦੋ ਤੋਂ ਢਾਈ ਸੌ ਮੈਚ ਲੱਗ ਜਾਂਦੇ ਹਨ ਲੂਡੋ ਦੇ ਜਿਸ ਵਿੱਚ ਸ਼ਰਤਾਂ ਵੀ ਹੁੰਦੀਆਂ ਹਨ ਠੰਡੇ ਦੀਆਂ ਬੋਤਲਾਂ ਛੋਟੀ ਮੋਟੀਆਂ ਸ਼ਰਤਾਂ ਮਤਲਬ ਬਹੁਤ ਹੀ ਜੀਅ ਲੱਗਿਆ ਰਹਿੰਦਾ ਹੈ ਅਤੇ ਵਿਹਲੇ ਟਾਈਮ ਜਾ ਕੇ ਮੈਂ ਆਪਣੇ ਦਾਦੇ ਕੋਲ ਵੀ ਬੈਠ ਜਾਂਦਾ ਹਾਂ ਅਤੇ ਉਹਨਾਂ ਤੋਂ ਖੇਤੀ ਪ੍ਰਤੀ ਡੰਗਰਾਂ ਪ੍ਰਤੀ ਬਹੁਤ ਹੀ ਜ਼ਿਆਦਾ ਜਾਣਕਾਰੀ ਇਕੱਠੀ ਕਰਦਾ ਹਾਂ ਜੋ ਕਿ ਮੇਰੇ ਅੱਗੇ ਭਵਿੱਖ ਵਿੱਚ ਬਹੁਤ ਹੀ ਕੰਮ ਕਾਰ ਆਏਗੀ